ਬਾਗਾਂ ਵਿੱਚ ਫਲਾਂ ਅਤੇ ਫੁੱਲਾਂ ਦੀ ਵਰਤੋਂ ਅਸੀਂ ਜ਼ਿੰਦਗੀ ਵਿੱਚ ਬਹੁਤ ਕਰਦੇ ਹਾਂ ਅਸੀਂ ਫਲਾਂ ਨੂੰ ਬਾਗ ਲਗਾਉਂਦੇ ਹਾਂ ਇਹਨਾਂ ਬਾਗਾਂ ਵਿੱਚੋਂ ਫਲਾਂ ਨੂੰ ਤੋੜਿਆ ਜਾਂਦਾ ਹੈ ਇਸ ਦੇ ਬਾਜ਼ਾਰ ਅਤੇ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ ਜਿਵੇਂ ਇਸ ਤੋਂ ਅਸੀਂ ਪੈਸੇ ਵੀ ਕਮਾਉਂਦੇ ਹਾਂ ਫਲਾਂ ਨੂੰ ਤੋਂ ਅਸੀਂ ਜੂਸ ਤਿਆਰ ਕਰਦੇ ਹਾਂ ਤਿਆਰ ਕਰਕੇ ਜੂਸ ਨੂੰ ਪੀਂਦੇ ਹਾਂ ਫਲਾਂ ਦੀ ਵਰਤੋਂ ਅਸੀਂ ਖਾਣ ਲਈ ਵੀ ਕਰਦੇ ਹਾਂ ਫਲਾਂ ਦੀ ਵਰਤੋਂ ਅਸੀਂ ਰੁਜ਼ਗਾਰ ਦੇ ਤੌਰ 'ਤੇ ਵੀ ਕਰਦੇ ਹਾਂ ਫੁੱਲਾਂ ਨੂੰ ਤੋੜ ਕੇ ਅਸੀਂ ਮੰਡੀਆਂ ਅਤੇ ਸ਼ਹਿਰਾਂ ਵਿੱਚ ਵੇਚ ਸਕਦੇ ਹਾਂ ਫੁੱਲਾਂ ਦੀ ਵਰਤੋਂ ਘਰ ਦੀ ਸਜਾਵਟ ਵਾਸਤੇ ਵੀ ਕੀਤੀ ਜਾਂਦੀ ਹੈ ਫੁੱਲਾਂ ਦੀ ਵਰਤੋਂ ਅਸੀਂ ਖੁਸ਼ਬੂ ਲਈ ਵੀ ਕਰਦੇ ਹਾਂ ਫੁੱਲਾਂ ਨੂੰ ਅਸੀਂ ਗੁਰਦੁਆਰੇ ਅਤੇ ਮੰਦਰਾਂ ਵਿੱਚ ਪੂਜਾ ਕਰਦੇ ਹਾਂ ਕਰਨ ਲਈ ਵੀ ਵਰਤੇ ਜਾਂਦੇ ਹਨ ਫੁੱਲਾਂ ਦੀ ਮਾਲਾ ਬਣਾ ਕੇ ਅਸੀਂ ਪ੍ਰੋਗਰਾਮਾਂ 'ਤੇ ਵਰਤਦੇ ਹਾਂ ਫੁੱਲਾਂ ਨਾਲ ਅਸੀਂ ਆਪਣੀਆਂ ਗੱਡੀਆਂ ਕਾਰਾਂ ਨੂੰ ਵੀ ਸਜਾਇਆ ਜਾਂਦਾ ਹੈ ਅਸੀਂ ਫ ਫਲਾਂ ਅਤੇ ਫੁੱਲਾਂ ਦੀ ਵਰਤੋਂ ਰੁਜ਼ਗਾਰ ਲਈ ਵੀ ਕਰਦੇ ਹਾਂ